ਮੈਂ ਸ਼ਹੀਦ ਭਗਤ ਸਿੰਘ ਨਗਰ ਵਿੱਚ ਰਹਿੰਦਾ ਏ ਠੀਕ ਹੈ ਜੀ ਜੇ ਗੱਲ ਕਰਿਆ ਜਾਵੇ ਖੇ ਖੇਤੀਬਾੜੀ ਲਈ ਅਤੇ ਇਸ ਵਿੱਚ ਨਵਾਂਸ਼ਹਿਰ ਵਿੱਚ ਬਹੁਤ ਜੀ ਖੇਤੀ ਖੁਤੀ ਕਰਕੇ ਬਹੁਤ ਪ੍ਰਸਿੱਧ ਹੈ ਪਰ ਦੇਖਿਆ ਜਾਵੇ ਤਾਂ ਇਸ ਸਾਡੇ ਇਲਾਕੇ 'ਚ ਬਹੁਤ ਜੀਆਂ ਫੈਕਟਰੀਆਂ ਨੇ ਜਿਹੜੀ ਕਿ ਰੁਜ਼ਗਾਰ ਚਲਾ ਰਹੀਆਂ ਨੇ ਕਈ ਬੰਦਿਆਂ ਦਾ ਕਈ ਇੱਥੇ ਸਾਰੇ ਬੰਦਿਆਂ ਦਾ ਚਲਾ ਰਹੀਆਂ ਇੱਧਰ ਆਪਣੇ ਪੰਜ ਸੱਤ ਫੈਕਟਰੀਆਂ ਨੇ ਜਿਹ 'ਚੋਂ ਕਿ ਜਿਹ 'ਚ ਦਵਾਈਆਂ ਬਣਦੀਆਂ ਗੱਡੀਆਂ ਬਣਦੀਆਂ ਗੱਡੀਆਂ ਦੇ ਪਾਰਟ ਬਣਦੇ ਹੈ ਫਿਲਮ ਬਣਦੇ ਹੈ ਦਵਾਈ ਬ ਕੈਮੀਕਲ ਵੀ ਬਣਦੇ ਐਂ ਕਾਪੀਆਂ ਬਣਦੀਆਂ ਨੇ ਜੋ ਕਿ ਬਹੁਤ ਬਹੁਤ ਹੀ ਬੰਦਿਆਂ ਦਾ ਰੁਜ਼ਗਾਰ ਚਲਾ ਰਹੀ ਹੈ ਅਤੇ ਬਹੁਤ ਹੀ ਸੁੱਖ ਸ਼ਾਂਤੀ ਨਾਲ ਚੱਲ ਰਹੇ ਨੇ ਇੱਥੇ ਮਰਦ ਔਰਤ ਦੋਹੇਂ ਕੰਮ ਕਰਦੇ ਨੇ ਅਤੇ ਬਹੁਤ ਸੇਵਾਵਾਂ ਨੇ ਬਹੁਤ ਜ਼ਿਆਦਾ ਵਧੀਆ ਸੈਲਰੀ ਦਿੰਦੇ ਨੇ ਪ੍ਰੋਵਾਈਡ ਕਰਦੇ ਨੇ ਇਹਨਾਂ ਕਰਕੇ ਬਹੁਤ ਬੰਦਿਆਂ ਦਾ ਰੁਜ਼ਗਾਰ ਮਿਲ ਰਿਹਾ ਹੈ ਵਧੀਆ ਚੱਲ ਰਿਹਾ ਉਹਨਾਂ ਦਾ ਰੁਜ਼ਗਾਰ ਦੇ ਹੋਰ ਤਰੱਕੀ ਕਰੀ ਜਾ ਰਹੇ ਆ ਸੈਲਰੀ ਵਧਾਉਂਦੇ ਆ ਉਹਨਾਂ ਦੀ ਤਰੱਕੀ ਕਰਦੇ ਨੇ